ਪੰਜਾਬ ਵਿੱਚ ਲੋਕ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਜਿਵੇਂ ਕਿ ਗਾਇਕੀ ਅਤੇ ਗੀਤ ਸੰਗੀਤ ਅਤੇ ਨਾਚ ਕਾਫ਼ੀ ਮਸ਼ਹੂਰ ਹਨ ਹਰ ਪਰਬ 'ਤੇ ਇਹ ਦੋਵੇਂ ਚੀਜ਼ਾਂ ਕਾਫ਼ੀ ਦੇਖੀਆਂ ਜਾਂਦੀਆਂ ਹਨ ਗਾਇਕੀ ਵੱਲ ਅਤੇ ਨਾਚ ਗਾਣੇ ਵੱਲ ਅੱਜ ਦੇ ਜੁਵਾਨ ਪੀੜ੍ਹੀ ਦੀ ਕਾਫ਼ੀ ਉਤਸੁਕਤਾ ਅਤੇ ਰੁਝਾਨ ਦੇਖਿਆ ਜਾ ਸਕਦਾ ਹੈ ਹਰ ਪਰਬ 'ਤੇ ਇਹ ਦੋਨਾਂ ਤੋਂ ਬਗੈਰ ਕੋਈ ਵੀ ਜਸ਼ਨ ਪੂਰਾ ਨਹੀਂ ਹੁੰਦਾ ਗਾਇਕੀ ਅਤੇ ਨਾਚ ਦੇ ਨਾਲ ਹੀ ਹਰ ਜਸ਼ਨ ਮਨਾਇਆ ਜਾਂਦਾ ਹੈ ਨਾਚ ਵਿੱਚ ਜਿਵੇਂ ਸਾਡਾ ਸਭ ਤੋਂ ਮਸ਼ਹੂਰ ਲੋਕ ਨਾਚ ਭੰਗੜਾ ਅੱਜ ਵੀ ਪੰਜਾਬ ਦੇ ਨੌਜਵਾਨਾਂ ਵਿੱਚ ਜਿੰਦਾ ਹੈ ਅਤੇ ਬੜੇ ਹੀ ਉਤਸ਼ਾਹ ਨਾਲ ਪਾਇਆ ਜਾਂਦਾ ਹੈ ਅਤੇ ਗਾਇਕੀ ਵੀ ਅੱਜ ਕੱਲ੍ਹ ਨੌਜਵਾਨਾਂ ਵਿੱਚ ਕਾਫ਼ੀ ਵੱਧ ਰਹੀ ਹੈ ਕਾਫ਼ੀ ਨੌਜਵਾਨਾਂ ਦਾ ਇਸ ਵਿੱਚ ਰੁਝਾਨ ਦੇਖਿਆ ਜਾ ਸਕਦਾ ਹੈ ਗਾਇਕੀ ਅਤੇ ਨਾਚ ਇੱਕ ਅਜਿਹੀ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੇ ਜੋ ਕਦੇ ਵੀ ਘੱਟ ਨਹੀਂ ਹੋ ਸਕਦੀਆਂ ਇਹਨਾਂ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਅੱਜ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀਆਂ ਹਨ ਅੱਜ ਦੀ ਜਵਾਨ ਪੀੜ੍ਹੀ ਗਾਇਕੀ ਅਤੇ ਲੋਕ ਨਾਚ ਵੱਲ ਕਾਫ਼ੀ ਉਤਸ਼ਾਹਿਤ ਹੈ ਅਤੇ ਇਹਨਾਂ ਦੇ ਕਾਫ਼ੀ ਕਾਫ਼ੀ ਵਿਰਲੇ ਵਿਰਲੇ ਭਾਗ ਵੀ ਹਨ